ਹੈਲੋ ਹਾਂਜੀ ਨਮਸਕਾਰ ਜੀ ਹਾਂਜੀ ਹਾਂਜੀ ਸਾਰਾ ਕੁਛ ਮਿਲ ਜਾਂਦਾ ਜੀ ਤੁਹਾਨੂੰ ਕੀ ਚਾਹੀਦਾ ਰਜਿਸਟਰ ਪੈਨ ਕਾਪੀ ਕੀ ਕੁਝ ਚਾਹੀਦਾ ਹਾਂਜੀ ਸਾਰਾ ਕੁਛ ਮਿਲ ਜਾਵੇਗਾ ਜੀ ਜਮੈਟਰੀ ਬਾਕਸ ਇੱਕ ਤਾਂ ਕੰਪਸ ਵਾਲੀ ਜਮੈਟਰੀ ਆਉਂਦੀ ਹੈ ਸਿੰਪਲ ਜਮੈਟਰੀ ਵੀ ਆਉਂਦੀ ਹੈ ਕੈਲਕੂਲੇਟਰ ਵਾਲੀ ਜਮੈਟਰੀ ਵੀ ਆਉਂਦੀ ਹੈ ਤੁਹਾਨੂੰ ਕਿਸ ਟਾਈਪ ਦੀ ਚਾਹੀਦੀ ਹੈ ਹਾਂਜੀ ਡਰੋਇੰਗ ਪੇਜਿਸ ਇੱਕ ਤਾਂ ਕਲਰਡ ਵਾਲੇ ਹੁੰਦੇ ਹੈ ਅਸਾਈਮੈਂਟ ਸ਼ੀਟਸ ਵਗੈਰਾ ਸਭ ਕੁਛ ਹੈ ਫਾਈਲਸ ਵਗੈਰਾ ਵੀ ਹੈ ਹਾਂਜੀ ਤੁਹਾਨੂੰ ਕਿੰਨੀ ਕੁ ਅਮਾਉਂਟ ਚਾਹੀਦੀ ਹੈ ਇਸਦੀ ਹਾਂਜੀ ਹਾਂਜੀ ਸਟੀਕਰਸ ਵਗੈਰਾ ਇੱਕ ਤਾਂ ਕਾਰਟੂਨਸ ਵਾਲੇ ਸਟੀਕਰਸ ਆਉਂਦੇ ਨੇ ਇੱਕ ਨੇਮ ਸਲਿਪ ਵੀ ਆਉਂਦੀ ਹੈ ਜਿਸ ਤਰ੍ਹਾਂ ਦੇ ਤੁਸੀਂ ਕਹੋਗੇ ਉਸ ਤਰ੍ਹਾਂ ਦੀ ਤੁਹਾਨੂੰ ਦੇ ਦੇਵਾਂਗੇ ਹਾਂਜੀ ਹਾਂਜੀ ਹਾਂਜੀ ਡਿਲੀਵਰ ਕਰਵਾ ਸਕਦੇ ਹਾਂ ਸਾਡੇ ਵਹੀਕਲਸ ਵੀ ਆਉਂਦੇ ਨੇ ਤੁਸੀਂ ਦੱਸ ਦਿਓ ਜੀ ਕਿੰਨੀ ਅਮਾਊਂਟ ਤੁਹਾਨੂੰ ਚਾਹੀਦੀ ਹੈ ਅਸੀਂ ਉਸ ਹਿਸਾਬ ਨਾਲ ਤੁਹਾਨੂੰ ਦੇ ਦਾਂਗੇ ਹਾਂਜੀ ਬਸ ਡਿਲੀਵਰੀ ਚਾਰਜਿਸ ਤੁਹਾਨੂੰ ਅਲੱਗ ਤੋਂ ਪੇਅ ਕਰਨੇ ਪੈਣਗੇ ਉਹਦੇ ਸਮਾਨ ਤੁਸੀਂ ਮੈਨੂੰ ਸਾਰਾ ਨੋਟ ਕਰਵਾ ਦਿਆ ਜੇ ਜੋ ਵੀ ਚਾਹੀਦਾ ਹੋਵੇ ਅਤੇ ਆਪਣਾ ਐਡਰੈਸ ਮੈਨੂੰ ਇਸ ਨੰਬਰ 'ਤੇ ਹੀ ਕਰ ਦਿਆ ਜੇ ਵਟਸਐਪ ਹਾਂਜੀ ਹਾਂਜੀ ਬੈਟ ਕੈਰਮ ਬੋਰਡ ਸਭ ਕੁਛ ਮਿਲ ਜਾਂਦਾ ਰੈਕਟ ਵਗੈਰਾ ਬੈਡਮਿੰਟਨ ਵਗੈਰਾ ਸਭ ਕੁਛ ਹੈ ਹਾਂਜੀ ਹਾਂਜੀ ਹਾਂਜੀ ਸਕੈਚਿਸ ਸਭ ਕੁਛ

ਫੁੱਟਬੋਲ ਵਗੈਰਾ ਤਾਂ ਨਹੀਂ ਹੋਵੇਗੀ ਉਹ ਚੀਜ਼ ਨਹੀਂ ਹੋਵੇਗੀ ਬਾਕੀ ਬੈਟ ਵਗੈਰਾ ਰੈਕਟਸ ਵਗੈਰਾ ਉਹ ਸਭ ਮਿਲ ਜੇਗਾ ਹਾਂਜੀ ਨਹੀਂ ਇੱਕ ਸਿੰਪਲ ਬਰਾਊਨ ਕਲਰਸ ਆਂਦ ਨੇ ਇੱਕ ਸਿੰਪਲ ਬਰਾਊਨ ਕਵਰ ਵੀ ਆਉਂਦੇ ਨੇ ਕਲਰਡ ਵੀ ਆਉਂਦੇ ਨੇ ਡਿਜ਼ਾਇਨਿੰਗ ਵਾਲੇ ਵੀ ਆਉਂਦੇ ਨੇ ਅਤੇ ਛੋਟੇ ਬੱਚਿਆਂ ਦੇ ਉੱਪਰ ਬਾਰਬੀਜ ਵਗੈਰਾ ਬਣੀਆਂ ਹੋਣਗੀਆਂ ਕਾਰਟੂਨਸ ਵਗੈਰਾ ਹਾਂਜੀ ਵਿਦਆਊਟ ਬਾਈਡਿੰਗ ਵੀ ਹੋਵੇਗੀ ਬਾਈਡਿੰਗ ਵਾਲਾ ਵੀ ਜਿਸ ਤਰ੍ਹਾਂ ਦਾ ਤੁਸੀਂ ਕਹੋਗੇ ਸਭ ਟਾਈਪ ਦਾ ਹੈ ਹਾਂਜੀ ਹਾਂਜੀ ਹਾਂਜੀ ਏ ਫੋਰ ਸਾਈਜ਼ ਦੇ ਮਿਲ ਜਾਣਗੇ ਹਾਂਜੀ ਠੀਕ ਹਾਂਜੀ ਡਿਜ਼ਾਇਨਿੰਗ ਰੇਜ਼ਰਸ ਨੇ ਹਾਂਜੀ ਡਿਜਾਇਨਿੰਗ ਇਰੇਜ਼ਰਸ ਵਗੈਰਾ ਡਿਜ਼ਾਇਨਿੰਗ ਸ਼ੋਪ ਵਗੈਰਾ ਸਭ ਕੁਛ ਮਿਲ ਜਾਵੇਗਾ ਹਾਂਜੀ ਹਾਂਜੀ ਹਾਂਜੀ ਹਾਂਜੀ ਕੋਈ ਗੱਲ ਨਹੀਂ ਹਾਂਜੀ ਠੀਕ ਹੈ ਜੀ ਕੀ ਚੀਜ਼ ਨਹੀਂ ਬੈਗ ਵਗੈਰਾ ਨਹੀਂ ਹੈਗੇ ਬੈਗ ਵਗੈਰਾ ਨਹੀਂ ਮਿਲਣਗੇ ਹਾਂਜੀ ਹਾਂਜੀ ਪੇਪਰ ਬੋਰਡ ਵਗੈਰਾ ਸਭ ਕੁਛ ਮਿਲ ਜਾਵੇਗਾ ਤੁਸੀਂ ਆ ਕੇ ਵਰਾਇਟੀ ਦੇਖ ਲਿਆ ਜੇ ਹਾਂਜੀ ਠੀਕ ਹੈ ਜੀ ਕੋਈ ਗੱਲ ਨਹੀਂ ਠੀਕ ਹੈ ਜੀ ਓਕੇ